ਹੈਲੋ ਹਾਂਜੀ ਹਾਂਜੀ ਹਾਂਜੀ ਜਦੋਂ ਮਰਜ਼ੀ ਆਉ ਜੀ ਮੋਸਟ ਵੈਲਕਮ ਪੰਜਾਬ ਵਿੱਚ ਤੁਹਡਾ ਆਉਣ 'ਤੇ ਹਾਂਜੀ ਆਪਣੇ ਕੋਲੋਂ ਤਰਨਤਾਰਨ ਤੋਂ ਆਪਣੇ ਸਾਰੇ ਪਾਸੇ ਟਰੇਨ ਜਾਂਦੀ ਜਲੰਧਰ ਵੀ ਜਾਂਦੀ ਹੈ ਅੰਮ੍ਰਿਤਸਰ ਵੀ ਜਾਂਦੀ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਤੁਸੀਂ ਕਿੱਥੇ ਘੁੰਮਣਾ ਚਾਹੋਗੇ ਦੱਸੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੁਹਨੂੰ ਵੀ ਸਾਰੀ ਬੁਕਿੰਗ ਵੀ ਇੱਥੋਂ ਹੋ ਜੂਗੀ ਤੁਹਾਨੂੰ ਖਾਣ ਪੀਣ ਵਾਸਤੇ ਸਭ ਕੁਝ ਵੀ ਟਰੇਨ 'ਚ ਮਿਲ ਜੂਗਾ ਤੁਹਾਡਾ ਸਭ ਵਧੀਆ ਹੋ ਜੂਗਾ ਅਤੇ ਤੁਸੀਂ ਜਿੱਦਾਂ ਜਲੰਧਰੋਂ ਚਾਰ ਤੋਂ ਛੇ ਸਵੇਰੇ ਚਾਰ ਵਜੇ ਆਉਂਦੀ ਸ਼ਾਮ ਨੂੰ ਛੇ ਵਜੇ ਆਉਂਦੀ ਆ ਅੰਮ੍ਰਿਤਸਰ ਤੋਂ ਜਿਹੜੀ ਜਾਂਦੀ ਹੈ ਜਲੰਧਰ ਉਹ ਹੈਗੀ ਹੈ ਦੋ ਤੋਂ ਚਾਰ ਵਜੇ ਦੱਸੋ ਤੁਸੀਂ ਜਿਹੜੇ ਟਾਈਮ ਦੱਸੋਗੇ ਉਸ ਦੀ ਮੈਂ ਬੁਕਿੰਗ ਕਰ ਦੂਗੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਜਦੋਂ ਆਖੋਗੇ ਉਸੇ ਆ ਜਿਓ ਜੇ ਆਪਾਂ ਨੂੰ ਘੁੰਮਾ ਦੇਵਾਂਗੇ ਟਰੇਨ ਵੀ ਬਾਏ ਕੂਲੀ ਵੀ ਸਭ ਕੁਛ ਤੁਹਾਨੂੰ ਮਿਲ ਜੁਗਾ